ਆਵਾਜ਼ ਦੀ ਸੁਰੱਖਿਆ ਲਈ ਬੰਦੇ ਨੂੰ ਮਤਲਬ ਕਾਫੀ ਐਫਟ ਕਰਨੇ ਪੈਂਦੇ ਆ ਹੈ ਨਾ ਕਿਉਂਕਿ ਆਪਾਂ ਜ਼ਿਆਦਾਤਰ ਡੇਲੀ ਰੂਟੀਨ ਵਿੱਚ ਆਪਣੇ ਆਪਣੇ ਘਰਾਂ ਵਿੱਚ ਆਪਾਂ ਡਾਲਡੇ ਘੀਓ ਦੀ ਵਰਤੋਂ ਕਰਦੇ ਹਾਂ ਜਾਂ ਕੋਈ ਆਪਾਂ ਤਲੀਆਂ ਤਲੀਆਂ ਚੀਜ਼ਾਂ ਖਾਂਦੇ ਰਹਿੰਦੇ ਹਾਂ ਹੈ ਨਾ ਇਹਨਾਂ ਨਾਲ ਕੀ ਹੁੰਦਾ ਮਤਲਬ ਗਲਾ ਜ਼ਿਆਦਾ ਖਰਾਬ ਹੋ ਜਾਂਦਾ ਹੈ ਨਾ ਇਸ ਕਰਕੇ ਬੰਦੇ ਨੂੰ ਬਹੁਤ ਜ਼ਿਆਦਾ ਦਿੱਕਤ ਆਉਂਦੀ ਹੈ ਬੋਲਣ ਕਰਨ 'ਚ ਵੀ ਹੈ ਨਾ ਅਤੇ ਜ਼ਿਆਦਾਤਰ ਬੰਦੇ ਨੂੰ ਮਤਲਬ ਇਹਦੇ 'ਚ ਨਾ ਗਰਮ ਪਾਣੀ ਕੋਸਾ ਪਾਣੀ ਪੀਂਦੇ ਰਹਿਣਾ ਚਾਹੀਦਾ ਕਿਉਂਕਿ ਜੇ ਆਪਾਂ ਗਰਮ ਪਾਣੀ ਜਾਂ ਕੋਸਾ ਪਾਣੀ ਪੀਵਾਂਗੇ ਨਾ ਉਹਦੇ 'ਚ ਕੀ ਬੰਦੇ ਦਾ ਗਲਾ ਹੈ ਜਿਹੜਾ ਮਤਲਬ ਤਰਲ ਹੁੰਦਾ ਰਹਿੰਦਾ ਹੈ ਨਾ ਗਲੇ ਤਰ੍ਹਾਂ ਕਿਸੇ ਤਰ੍ਹਾਂ ਦੀ ਖਰਾਸ਼ ਨਹੀਂ ਹੁੰਦੀ ਹੈਗੀ ਜੇ ਗਲੇ 'ਚ ਕਿਸੇ ਵੀ ਤਰ੍ਹਾਂ ਦੀ ਕੋਈ ਖਰਾਸ਼ ਨਾ ਆਉਗੀ ਤਾਂ ਆਟੋਮੈਟਿਕ ਹੀ ਹੈ ਜਿਹੜੀ ਉਹ ਹੈ ਉਹ ਆਵਾਜ਼ ਹੈ ਉਹ ਸੁਰੱਖਿਅਤ ਰਹੇਗੀ ਕਈ ਕੀ ਹੈ ਵੀ ਮਤਲਬ ਸਾਨੂੰ ਇੱਦਾਂ ਦਾ ਜਦੋਂ ਮਤਲਬ ਬੰਦਾ ਜ਼ਿਆਦਾ ਉਹ ਕਰਦਾ ਉੱਚੀ ਬੋਲਦਾ ਉਹ ਗਲਾ ਬੈਠਣ ਦੇ ਚਾਂਸਿਸ ਜ਼ਿਆਦਾ ਹੁੰਦੇ ਹੈ ਨਾ ਤਾਂ ਬੰਦੇ ਮਤਲਬ ਜਦੋਂ ਗਲਾ ਖਰਾਬ ਹੁੰਦਾ ਬੰਦੇ ਨੂੰ ਮਿਸ਼ਰੀ ਵਗੈਰਾ ਦਾ ਜਾਂ ਇਲਾਇਚੀ ਦਾ ਸੇਵਨ ਕਰਨਾ ਚਾਹੀਦਾ ਹੈ ਨਾ ਕਿਉਂਕਿ ਜੇ ਆਪਾਂ ਇਲਾਇਚੀ ਦਾ ਸੇਵਨ ਕਰਾਂਗੇ ਜਾਂ ਮਤਲਬ ਮਿਸ਼ਰੀ ਦਾ ਸੇਵਨ ਕਰਾਂਗੇ ਉਹਨੇ ਜਿਹੜੀ ਆਵਾਜ਼ ਆਪਣੀ ਉਹ ਸੁਰੱਖਿਅਤ ਰਹੇਗੀ ਅਤੇ ਜਿਹੜਾ ਗਲਾ ਜਿਹੜਾ ਮਤਲਬ ਬੈਠਣ ਦੇ ਉਹ ਚਾਂਸ ਬਹੁਤ ਘੱਟ ਹੈ ਬੰਦੇ ਨੂੰ ਜ਼ਿਆਦਾਤਰ ਮਤਲਬ ਤਲੀਆਂ ਚੀਜ਼ਾਂ ਦਾ ਪਰਹੇਜ ਕਰਨਾ ਚਾਹੀਦਾ ਤਲੀਆਂ ਜ਼ਿਆਦਾਤਰ ਤਲੀਆਂ ਚੀਜ਼ਾਂ ਨਾਲ ਹੀ ਪ੍ਰੋਬਲਮ ਆਉਂਦੀ ਹੈ ਬੰਦੇ ਨੂੰ ਅਦਰਵਾਈਜ਼ ਬੰਦੇ ਨੂੰ ਕੋਈ ਪ੍ਰੋਬਲਮ ਨਹੀਂ ਆਉਂਦੀ ਹੈਗੀ